ਸਾਡੇ ਖੇਤਰ ਦੀ ਗੱਲ ਕਰੀਏ ਤਾਂ ਮੈਂ ਇਹੋ ਜਿਹੇ ਪਟਿਆਲੇ ਦੇ ਆਸ ਪਾਸ ਰਹਿੰਦੀ ਹਾਂ ਜਿੱਥੇ ਜਾਂ ਚੰਡੀਗੜ ਦੇ ਨੇੜੇ ਵੀ ਪੈਂਦਾ ਸਾਡਾ ਇਲਾਕਾ ਜਿੱਥੇ ਕੀ ਆ ਵੀ ਬੜੀਆਂ ਸਾਰੀਆਂ ਸੋਸਾਇਟੀਆਂ ਕਹਿ ਲਉ ਜਾਂ ਇਹੋ ਜਿਹੇ ਰੰਗ ਮੰਚ ਨੇ ਜਿੱਥੇ ਅੱਡ ਅੱਡ ਕਲਾਕਾਰਾਂ ਨੂੰ ਲਈ ਜਿਹੜੀਆਂ ਸ ਅ ਬਣੀਆਂ ਹੋਈਆਂ ਨੇ ਸੋਸਾਇਟੀਆਂ ਜਿਨ੍ਹਾਂ ਦੇ ਵਿੱਚ ਮੈਂ ਕਲਾਕਾਰ ਰੰਗ ਮੰਚ ਹੈ ਜ਼ਾਂ ਪੰਜਾਬੀ ਕਲਾਕ੍ਰਿਤੀ ਹੈ ਜਾਂ ਫਿਰ ਕਵੀ ਸੰਵ ਜਿਹੜੀਆਂ ਹੈਗੀਆਂ ਨੇ ਸੋਸਾਇਟੀਆਂ ਨੇ ਜਿਨ੍ਹਾਂ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਕਲਾਕਾਰਾਂ ਨੂੰ ਅੱਡ ਅੱਡ ਜਿਹੜਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਅਤੇ ਉਹਦੇ ਨਾਲ ਉਹਨਾਂ ਦੀ ਕਲਾ 'ਚ ਹੋਰ ਨਿ ਨਿਖਾਰ ਆਉਂਦਾ ਇਹਨਾਂ ਕਲਾ ਸਮਾਗਮਾਂ 'ਤੇ ਜਿਵੇਂ ਲੋਕ ਨ੍ਰਿੱਤ ਜਿਹੜਾ ਹੈਗਾ ਸਪਿੱਕ ਮੈਕੇ ਇੱਕ ਹੈਗੀ ਆ ਪੰਜਾਬੀ ਦੀ ਸੋਸਾਇਟੀ ਉਹਦੇ 'ਚ ਕੀ ਹੈ ਲੋਕ ਉਹ ਕਾਹਦੇ ਬਾਰੇ ਪੇਸ਼ ਕਰਦੀ ਹੈ ਉਹ ਲੋਕ ਨ੍ਰਿੱਤ ਜਿਹੜੇ ਨੇ ਉਹਨਾਂ ਨੂੰ ਪੇਸ਼ ਕਰਦੀ ਹੈ ਸੋ ਉੱਥੇ ਜਿਹੜੇ ਅੱਡ ਅੱਡ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਨੇ ਉਹ ਜਾ ਕੇ ਆਪਣਾ ਹਿੱਸਾ ਲੈ ਸਕਦੇ ਨੇ ਅਤੇ ਜਾਂ ਜਿਹੜੇ ਉਭਰਦੇ ਕਲਾਕਾਰ ਨੇ ਜਾਂ ਥੀਏਟਰ ਹੈ ਜਿਵੇਂ ਥੀਏਟਰ ਦੇ ਵਿੱਚ ਜਿਹੜੇ ਥੀਏਟਰ ਦੇ ਕਲਾਕਾਰ ਨੇ ਉਹ ਅੱਡ ਅੱਡ ਜਿਹੜੀਆਂ ਇਹਦੀਆਂ ਸੋਸਾਇਟੀਆਂ ਨੇ ਜਾਂ ਰੰਗਮੰਚ ਨੇ ਉਹਨਾਂ ਦੇ ਅੰਡਰ ਜਿਹੜਾ ਰਜਿਸਟਰ ਹੋ ਕੇ ਜਾਂ ਫਿਰ ਬੜਾ ਵਾਰੀ ਜਿਹੜੇ ਸਕੂਲ ਕੋਲਜਾਂ ਦੇ ਵੀ ਖੇਤਰੀ ਸਮਾਗਮ ਹੁੰਦੇ ਨੇ ਉਹਨਾਂ ਦੇ ਦੁਆਰਾ ਜਿਹੜਾ ਆਪਣਾ ਜਿਹੜਾ ਕਲਾ ਦਾ ਪ੍ਰਦਰਸ਼ਨ ਕਰ ਸਕਦੇ ਨੇ ਜਿਹੜੇ ਅੱਗੇ ਜਾ ਕੇ ਕਲਾਕਾਰੀ ਲਈ ਬੜੇ ਕੰਮ ਆਉਂਦੇ ਨੇ